ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਪੁੱਛੋ ਹਾਂਜੀ ਮਿਲ ਜਾਣਗੀਆਂ ਤੁਹਾਨੂੰ ਹਾਂਜੀ ਤੁਹਾਨੂੰ ਹਰੇਕ ਪ੍ਰਕਾਰ ਦੀ ਬੁੱਕ ਮਿਲ ਜਾਏਗੀ ਤੁਸੀਂ ਬੁੱਕ ਇਸ਼ੂ ਕਰਵਾਉਣ ਵਾਸਤੇ ਬੁੱਕ ਇਸ਼ੂ ਕਰਵਾਉਣ ਪੰਦਰਾਂ ਦਿਨ ਵਾਸਤੇ ਇਸ਼ੂ ਹੁੰਦੀ ਹੈ ਹਾਂਜੀ ਅਤੇ ਜੇ ਤੁਸੀਂ ਲਾਇਬ੍ਰੇਰੀ ਵਿੱਚ ਆ ਕੇ ਪੜ੍ਹਨਾ ਚਾਹੁੰਦੇ ਹੋ ਲਾਇਬ੍ਰੇਰੀ ਦਾ ਸਮਾਂ ਸੁਬਹਾ ਸੱਤ ਵਜੇ ਤੋਂ ਸ਼ਾਮ ਪੰਜ ਵਜੇ ਤੱਕ ਹੈਗਾ ਆ ਹਾਂਜੀ ਹਾਂਜੀ ਉਹ ਕਾਰਡ ਮਿਲ ਜਾਣਗੇ ਤੁਹਾਨੂੰ ਜਦੋਂ ਤੁਸੀਂ ਸਾਡੇ ਕੋਲ ਆਓਗੇ ਹਾਂਜੀ ਹਾਂ ਤੁਹਾਡਾ ਕਾਰਡ ਬਣਾ ਦਿਤਾ ਜਾਏਗਾ ਲਾਈਬ੍ਰੇਰੀ ਦਾ ਉਹ ਤੁਹਾਨੂੰ ਪਹਿਲਾਂ ਨਹੀਂ ਤੁਸੀਂ ਪੰਦਰਾਂ ਦਿਨ ਵਾਸਤੇ ਲੈ ਸਕਦੇ ਹੋ ਬਾਅਦ ਵਿੱਚ ਸਾਨੂੰ ਜਮਾਂ ਕਰਾ ਕੇ ਦੁਬਾਰਾ ਫਿਰ ਤੁਸੀਂ ਇਸ਼ੂ ਕਰਵਾ ਸਕਦੇ ਹੋ ਬੁੱਕ ਨਹੀ ਮੈਮ ਉਹ ਪਹਿਲਾਂ ਪੂਰੀ ਸਹੂਲਤ ਮਿਲੇਗੀ ਇੱਥੇ ਪੱਖੇ ਵੀ ਲੱਗੇ ਹਨ ਏ ਸੀ ਵੀ ਲੱਗੇ ਹੋਏ ਨੇ ਪੂਰਾ ਪੂਰੀ ਖੁੱਲ੍ਹੀ ਖੁੱਲ੍ਹੀ ਹਵਾਦਾਰ ਲਾਇਬ੍ਰੇਰੀ ਹੈ ਸਾਡੀ ਹਾਂਜੀ ਹਾਂਜੀ ਜੋ ਵੀ ਹਰ ਇੱਕ ਪਾਠ ਆਪਦਾ ਪੰਜਾਬੀ ਟੈਸਟ ਹੁੰਦੇ ਆ ਵਾ ਉਹਦੀਆਂ ਹਰੇਕ ਪ੍ਰਕਾਰ ਦੀ ਬੁੱਕ ਮਿਲ ਜਾਂਦੀ ਆ ਇੱਥੇ ਹੋਰ ਵੀ ਬੱਚੇ ਆਉਂਦੇ ਨੇ ਸਾਡੀ ਲਾਈਬਰੇਰੀ ਵਿੱਚ ਹਾਂ ਹਾਂਜੀ ਹਾਂਜੀ ਹਰੇਕ ਬੁੱਕ ਜਿੱਦਾਂ ਦੀ ਵੀ ਇਤਿਹਾਸ ਨਾਲ ਸਬੰਧਿਤ ਬੁੱਕਾਂ ਬੁੱਕ ਇੱਕ ਕੋਰਨਰ 'ਚ ਹੋਏਗੀ ਟੈਟ ਨਾਲ ਜਿਹੜੀਆਂ ਸਬੰਧਿਤ ਬੁੱਕਸ ਹੁੰਦੀਆਂ ਉਹ ਅਲੱਗ ਕੋਰਨਰ ਵਿੱਚ ਹੋਣਗੀਆਂ ਤੁਹਾਨੂੰ ਕੋਈ ਦਿੱਕਤ ਨਹੀਂ ਆਏਗੀ ਹਾਂਜੀ ਹਾਂਜੀ ਹਾਂਜੀ ਹਰ ਹਰੇਕ ਦੀ ਬੁੱਕ ਹੋਏਗੀ ਹਾਂਜੀ ਓਕੇ ਥੈਂਕ ਯੂ ਤੁਸੀਂ ਜ਼ਰੂਰ ਆਇਓ ਸਾਡੀ ਲਾਇਬ੍ਰੇਰੀ ਵਿੱਚ ਤੁਹਾਨੂੰ ਹਰੇਕ ਪ੍ਰਕਾਰ ਦੀ ਮਿਲ ਜਾਏਗੀ ਇੱਥੇ ਹਾਂਜੀ ਠੀਕ ਆ ਕੋਈ ਗੱਲ ਨਹੀਂ